ਪੰਜਾਬੀ ਸਿਹਤ ਸੰਭਾਲ ਤਾਂ ਇਹ ਹੈ ਕਿ ਪੰਜਾਬ 'ਚ ਬਹੁਤ ਅੱਛੇ ਡੋਕਟਰ ਹਨ ਜਿਵੇਂ ਕਿ ਭਗਵੰਤ ਮਾਨ ਨੇ ਵੀ ਕਾਫੀ ਤਰ੍ਹਾਂ ਦੇ ਮੁਹੱਲਾ ਕਲੀਨਿਕ ਖੋਲ੍ਹੇ ਹੋਏ ਨੇ ਅਤੇ ਵਧੀਆ ਡਾਕਟਰ ਹੈ ਵਧੀਆ ਤਰ੍ਹਾਂ ਤਰੀਕੇ ਨਾਲ ਟਰੀਟਮੈਂਟ ਦਿੱਤੀ ਜਾਂਦੀ ਹੈ ਜਿਵੇਂ ਕਿ ਹਰ ਚੀਜ਼ ਦੇ ਫਰੀ ਟੈਸਟ ਹੁੰਦੇ ਹਨ ਸਿਹ ਸਿਹਤ ਦਾ ਧਿਆਨ ਰੱਖਦੇ ਹਨ ਸਾਰੇ ਇਸ ਕਰਕੇ ਪੰਜਾਬ 'ਚ ਵਧੀਆ ਡੋਕਟਰ ਰੱਖੇ ਹਨ ਪੇਸ਼ਾਵਰ ਫਰੈਂਡ ਸਰਕਾਰ ਦੁਆਰਾ ਚਲਾਈਆਂ ਗਈਆਂ ਕਾਫੀ ਸਹੂਲਤਾਂ ਦਿੱਤੀਆਂ ਗਈਆਂ ਮੈਡੀਸਨ ਬਾਰੇ ਫਰੀ ਮੈਡੀਸਨ ਦਿੱਤੀਆਂ ਗਈਆਂ ਵਾ ਫਰੀ ਚੈਕ ਹੁੰਦੇ ਆ ਫਰੀ ਇਲਾਜ ਹੁੰਦਾ ਫਰੀ ਕਲੀਨਿਕ ਮੁਹੱਲਾ ਕਲੀਨਿਕ ਖੋਲੇ ਉੱਥੇ ਵਧੀਆ ਤਰੀਕੇ ਨਾਲ ਦੇਖਿਆ ਜਾਂਦਾ ਹੈ ਹਾਂਜੀ